ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਥਾਨਕ ਸਿੱਖਿਆ ਦੇ ਜਾਂ ਸਿੱਖਣ ਦੇ ਬਹੁਤ ਸਾਰੇ ਮੌਕੇ ਨੇ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿੱਥੇ ਕਿ ਵਿਦਿਆਰਥੀ ਬਹੁਤ ਵਧੀਆ ਸਿੱਖਿਆ ਪ੍ਰਾਪਤ ਕਰ ਸਕਦੇ ਨੇ ਸਭ ਤੋਂ ਵੱਡੀ ਜਿਹੜੀ ਇੱਥੇ ਯੂਨੀਵਰਸਿਟੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਥੇ ਸਥਿਤ ਹੈ ਜਿੱਥੇ ਬਹੁਤ ਦੂਰੋਂ ਦੂਰੋਂ ਬੱਚੇ ਜਿਹੜੇ ਨੇ ਪੜ੍ਹਨ ਲਈ ਆਉਂਦੇ ਨੇ ਅਫਗਾਨਿਸਤਾਨ ਤੋਂ ਕਾਫੀ ਦੂਰੋਂ ਦੂਰੋਂ ਵੀ ਆ ਜਾਂਦੇ ਨੇ ਇਸ ਤੋਂ ਇਲਾਵਾ ਗੌਰਮੈਂਟ ਕਾਲਜ ਹੈ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਹੈ ਖਾਲਸਾ ਕਾਲਜ ਦੂਸਰਾ ਹੈ ਪੋਲੀਟੈਕਨਿਕ ਕਾਲਜ ਹੈ ਗੁਰੂ ਰਾਮਦਾਸ ਮੈਡੀਕਲ ਕਾਲਜ ਹੈ ਹੋਰ ਡੀਏਵੀ ਕਾਲਜ ਜਿਹੜੇ ਹੈਗੇ ਨੇ ਉਹ ਬਹੁਤ ਸਾਰਾ ਮਤਲਬ ਇਸ ਚੀਜ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਇੰਨੇ ਜ਼ਿਆਦਾ ਇੱਥੇ ਕਾਲਜ ਨੇ ਬੰਦਾ ਮਤਲਬ ਜਿਹੜੇ ਨੇ ਬੀਐਡ ਕਾਲਜ ਹੈ ਇੱਥੇ ਬੱਚੇ ਜਿਹੜੇ ਨੇ ਬਹੁਤ ਸਾਰਾ ਆਪਣੇ ਜਿਹੜੇ ਨੇ ਪ੍ਰੋਫੈਸ਼ਨਲੀ ਤਿਆਰੀ ਵੀ ਕਰ ਕਰਦੇ ਨੇ ਬੜਾ ਕੁਛ ਇੱਥੇ ਹੈ ਜਿਹੜਾ ਕਿ ਬੱਚਾ ਅੰਮ੍ਰਿਤਸਰ ਵਿੱਚ ਰਹਿੰਦਾ ਉਹਨੂੰ ਕਿਤੇ

ਪਹਿਲਾਂ ਵਾਲੇ ਹਾਲਾਤ ਨਹੀਂ ਰਹੇ ਸਰਕਾਰੀ ਸਕੂਲਾਂ ਦੇ ਵਿੱਚ ਸਮਾਰਟ ਸਕੂਲ ਉਹਨਾਂ ਨੂੰ ਬਣਾ ਦਿੱਤਾ ਗਿਆ ਹੈ ਵਿਦਿਆਰਥੀਆਂ ਦੇ ਪੜ੍ਹਨ ਲਈ ਬਹੁਤ ਉਹਨਾਂ ਨੂੰ ਫਰੀ ਐਜੂਕੇਸ਼ਨ ਹੈ ਫਰੀ ਉਹਨਾਂ ਨੂੰ ਬੁਕਸ ਨੇ ਬੜਾ ਕੁਝ ਦਿੱਤਾ ਜਾਂਦਾ ਤਾਂ ਸਰਕਾਰੀ ਸਕੂਲ ਜਿਹੜੇ ਨੇ ਉਹ ਵੀ ਇਸ ਸਮੇਂ ਬਹੁਤ ਵਧੀਆ ਚੱਲ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਜੇ ਪੜ੍ਹਾਈ ਦਾ ਮੌਕਾ ਦੇਖੀਏ ਤਾਂ ਬਹੁਤ ਵਧੀਆ ਇਹ ਚੀਜ਼ਾਂ ਚੱਲ ਰਹੀਆਂ ਨੇ